ਭੰਗੜਾ ਆਰੋਬਿਕਸ ਆਉਣ ਵਾਲੇ ਸਮੇਂ ਵਿੱਚ ਬਹੁਤ ਹੀ ਪ੍ਰਸਿੱਧ ਹੋਵੇਗਾ ਕਿਉਂਕਿ ਭੰਗੜਾ ਔਰ ਐਰੋਬਿਕਸ ਤੁਸੀਂ ਅਗਰ ਮਿਕਸ ਮਿਸ਼ਰਿਤ ਕਰਕੇ ਤੁਸੀਂ ਕਰਦੇ ਹੋ ਤਾਂ ਬਹੁਤ ਹੀ ਤੁਹਾਡੇ ਸਰੀਰ ਵਾਸਤੇ ਫਾਇਦੇਮੰਦ ਹੋ ਸਕਦਾ ਹੈ ਕਿਉਂਕਿ ਭੰਗੜਾ ਜਦੋਂ ਤੁਸੀਂ ਪਾਉਂਦੇ ਹੋ ਜਾਂ ਐਰੋਬਿਕਸ ਕਰਦੇ ਹੋ ਤੁਹਾਡੇ ਸਰੀਰ ਦੀਆਂ ਜਿਹੜੇ ਅੰਗ ਹੁੰਦੇ ਨੇ ਜਿੱਦਾਂ ਮੋਢੇ ਹੋ ਗਏ ਜਾਂ ਹੱਥ ਹੋ ਗਏ ਲੱਤਾਂ ਹੋ ਗਈਆਂ ਪੈਰ ਹੋ ਗਏ ਉਹ ਬੜੇ ਫਿਟ ਰਹਿੰਦੇ ਆ ਜਿਹਦੇ ਕਰਕੇ ਭੰਗੜਾ ਤੁਸੀਂ ਪਾਉਂਦੇ ਹੋ ਜਾਂ ਐਰੋਬਿਕਸ ਕਰਦੇ ਓ ਅਗਰ ਦੋਨਾਂ ਨੂੰ ਤੁਸੀਂ ਮਿਸ਼ਰਿਤ ਕਰਕੇ ਕਰਦੇ ਹੋ ਤਾਂ ਤੁਹਾਡੇ ਸਰੀਰ ਉੱਤੇ ਬਹੁਤ ਹੀ ਵਧੀਆ ਅਸਰ ਪੈ ਸਕਦਾ ਹੈ ਇਸ ਕਰਕੇ ਆਉਣ ਵਾਲੇ ਸਮੇਂ ਵਿੱਚ ਭਵਿੱਖ ਵਿੱਚ ਦੋਨੇ ਹੀ ਮਿਕਸ ਕਰਕੇ ਭੰਗੜਾ ਐਰੋਬਿਕਸ ਬਹੁਤ ਹੀ ਪ੍ਰਸਿੱਧ ਹੋਣ ਵਾਲਾ ਹੈ ਇਸ ਕਰਕੇ ਇਸ ਨੂੰ ਮਤਲਬ ਅਪਣਾਉਣਾ ਚਾਹੀਦਾ ਹੈ